ਭੰਗੜਾ ਇੱਕ ਐਰੋਬਿਕਸ ਦਾ ਬਹੁਤ ਵਧੀਆ ਸਾਧਨ ਹੈ ਐਰੋਬਿਕਸ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਭੰਗੜਾ ਸਾਨੂੰ ਜੋਸ਼ ਚੜ੍ਹਾਉਂਦਾ ਹੈ ਮੈਂ ਰੋਜ਼ ਐਰੋਬਿਕਸ ਕਰਦੀ ਹਾਂ ਅਤੇ ਪਿੱਛੇ ਭੰਗੜੇ 'ਤੇ ਗਾਣੇ ਹੀ ਲਾਂਦੀ ਹਾਂ ਪੰਜਾਬੀ ਭੰਗੜੇ ਦੇ ਮੇਨ ਗਿੱਪੀ ਗਰੇਵਾਲ ਅਤੇ ਪਰਮੀਸ਼ ਵਰਮਾ ਦੇ ਗਾਣੇ ਸੁਣਦੀ ਹਾਂ ਅੱਜ ਕੱਲ੍ਹ ਏਪੀ ਢਿੱਲੋ ਦੇ ਗਾਣੇ ਵੀ ਬੜੇ ਮਸ਼ਹੂਰ ਹਨ ਬੈਡ ਬੋਅਏ ਵਰਗੇ ਕਈ ਗਾਣੇ ਹਨ ਜਿਹਨਾਂ 'ਤੇ ਐਰੋਬਿਕਸ ਬਹੁਤ ਵਧੀਆ ਹੁੰਦਾ ਹੈ ਲੈਂਬਰਗਿਨੀ ਚਲਾਈ ਜਾਂਦੇ ਵੀ ਅੱਜ ਦਾ ਬਹੁਤ ਵਧੀਆ ਗਾਨਾ ਹੈਗਾ ਜਿਹੜਾ ਕਿ ਬਹੁਤ ਫੇਮਸ ਹੈ ਅਤੇ ਗਿੱਪੀ ਗਰੇਵਾਲ ਦੇ ਕੁਛ ਸੋ ਗਾਣੇ ਜਿੱਦਾਂ ਗੱਬਰੂ ਹਥਿਆਰ ਦੋ ਇਹਨਾਂ ਉੱਤੇ ਭੰਗੜਾ ਬਹੁਤ ਵਧੀਆ ਪਾਇਆ ਜਾਂਦਾ ਹੈ ਬੋਲੀਆਂ ਚੱਕ ਚੱਕ ਕੇ ਜੇ ਭੰਗੜਾ ਕੀਤਾ ਜਾਵੇ ਤਾਂ ਉਸ ਦਾ ਵਧੀਆ ਨਸ਼ਾ ਅਤੇ ਉਹਦਾ ਅਸਰ ਵੀ ਬਹੁਤ ਹੀ ਵਧੀਆ ਹੁੰਦੇ ਹਨ ਕੁਛ ਪਰਮੀਸ਼ ਵਰਮਾ ਦੇ ਵੀ ਗਾਣੇ ਹਨ ਜਿਹੜੇ ਕਿ ਬਤੌਰ ਰੌਨਕ ਵੀ ਲਾਉਂਦੇ ਹਨ ਅਤੇ ਤੁਹਾਨੂੰ ਮਜ਼ਾ ਵੀ ਆਉਂਦਾ ਹੈ ਐਰੋਬਿਕਸ ਕਰਕੇ ਮੂਵ ਯਰ ਲੱਕ ਦਿਲ ਚੋਰੀ ਸਾਡਾ ਹੋ ਗਿਆ ਗੱਭਰੂ ਕਈ ਗਾਣੇ ਹੈ ਜਿਹੜੇ ਬਹੁਤ ਹੀ ਵਧੀਆ ਐਰੋਬਿਕਸ ਕਰਾਉਂਦੇ ਹਨ ਜੱਟ ਜ਼ਿਮੀਦਾਰ ਅਤੇ ਏਪੀ ਢਿੱਲੋ ਦੇ ਗਾਣੇ ਦਿਲਜੀਤ ਦੋਸਾਂਝ ਦੇ ਗਾਣੇ ਇਹ ਸਾਰੇ ਗਾਣੇ ਸਾਨੂੰ ਪਾਗਲ ਵਰਲਡ 'ਤੇ ਮਿਲ ਜਾਂਦੇ ਹਨ ਅਤੇ ਉਹ ਗਾਣਿਆਂ ਉੱਤੇ ਤੁਸੀਂ ਐਰੋਬਿਕਸ ਕਰੋ ਜਾਂ ਭੰਗੜਾ ਕਰੋ ਅਤੇ ਦੋਨੋਂ ਇਕੱਠੇ ਕਰਕੇ ਮਜ਼ੇ ਲਓ ਭੰਗੜਾ ਸਾਦੀ ਲੋਕ ਨਾਚ ਇੱਕ ਵੱਡਾ ਪਹਿਲੂ ਹੈ ਅਤੇ ਇਹਨੂੰ ਜੇ ਬਰਕਰਾਰ ਕੀਤਾ ਜਾਵੇ ਐਰੋਬਿਕਸ ਦੇ ਗਾਨਿਆਂ ਨਾਲ ਤਾਂ ਵੀ ਸਾਡਾ ਦਿਲ ਲੱਗਿਆ ਰਹਿੰਦਾ ਹੈ ਦਿਲਜੀਤ ਦੋਸਾਂਝ ਦੇ ਗਾਨੇ ਵਿੱਚ ਤਾਂ ਐਰੋਬਿਕਸ ਬਹੁਤ ਵਧੀਆ ਹੁੰਦਾ ਹੈ ਅਤੇ ਭੰਗੜਾ ਬਹੁਤ ਮਜ਼ੇਦਾਰ ਥਿਰਕਦਾ ਹੈ ਪੰਜਾਬੀ ਗਾਣਿਆਂ ਤੋਂ ਵਧੀਆ ਕੋਈ ਇੱਦਾਂ ਦਾ ਜੋਸ਼ ਵਾਲਾ ਗਾਣਾ ਨਹੀਂ ਪੂਰੀ ਦੁਨੀਆਂ ਵਿੱਚ ਪੰਜਾਬੀ ਇੰਨੀ ਕੁ ਫੱਬਦੀ ਹੈ ਕਿ ਅੰਗਰੇਜ਼ ਵੀ ਅੱਜ ਕੱਲ੍ਹ ਪੰਜਾਬੀ ਗਾਣਿਆਂ ਉੱਤੇ ਐਰੋਬਿਕਸ ਕਰਦੇ ਹਨ